ਸਾਡੇ ਪਿੰਡ 'ਚ ਕਾਫੀ ਤਰ੍ਹਾਂ ਦੇ ਬਿਜ਼ਨਸ ਕੀਤੇ ਜਾਂਦੇ ਆ ਜਿਵੇਂ ਕਿ ਮੁੱਖ ਧੰਦਾ ਤਾਂ ਕਰਿਆਨੇ ਦੀ ਦੁਕਾਨ ਦਾ ਵਾ ਜਿਸ ਤੋਂ ਪਿੰਡ ਦੇ ਲੋਕ ਹਰ ਤਰ੍ਹਾਂ ਦਾ ਸੌਦਾ ਜਿਹੜਾ ਵਾ ਖੜ੍ਹਦੇ ਆ ਜਿਵੇਂ ਖੰਡ ਪੱਤੀ ਘਿਓ ਦਾਲ ਇਹ ਸਾਰਾ ਕੁਛ ਜਿਹੜਾ ਵਾ ਆਮ ਰਟੀਨ ਜ਼ਿੰਦਗੀ ਦੇ ਵਿੱਚ ਵਰਤਣਾ ਇਹ ਤੋਂ ਬਿਨਾ ਰੋਜ਼ ਦਾ ਗੁਜ਼ਾਰਾ ਹੀ ਨਹੀਂ ਆ ਇਸ ਲਈ ਇਹ ਕਾਫੀ ਜ਼ਿਆਦਾ ਜਿਹੜਾ ਵਾ ਕਰਿਆਨੇ ਦਾ ਵਪਾਰ ਚਲਦਾ ਵਾ ਔਰ ਪਿੰਡ ਦੇ ਵਿੱਚ ਟੈਂਟ ਦੀਆਂ ਦੁਕਾਨਾਂ ਵਾ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਵਿਆਹ ਸ਼ਾਦੀਆਂ ਦੇ ਜਾਂ ਕੋਈ ਜਨਮਦਿਨ ਦੀ ਪਾਰਟੀਆਂ ਸੋਗ 'ਤੇ ਮਰਗ 'ਤੇ ਟੈਂਟ ਦਾ ਜਿਹੜਾ ਵਾ ਸਮਾਨ ਚਾਹੀਦਾ ਹੁੰਦਾ ਵਾ ਅਤੇ ਕਾਫੀ ਚੰਗਾ ਵਪਾਰ ਹੈ ਜਿਹੜਾ ਵਾ ਇਸੇ ਤੋਂ ਹੁੰਦਾ ਵਾ ਮੋਟਰਸਾਈਕਲ ਰਿਪੇਅਰ ਦੀਆਂ ਦੁਕਾਨਾਂ ਵਾ ਹੇਅਰ ਕਟਿੰਗ ਦੀਆਂ ਨਾਈ ਦੀਆਂ ਦੁਕਾਨਾਂ ਹੈਗੀਆਂ ਵਾ ਕਾਫੀ ਤਰ੍ਹਾਂ ਦਾ ਬਿਜਨਸ ਜਿਹੜਾ ਵਾ ਚੱਲ ਰਿਹਾ ਵਾ